ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਪੌਦਿਆਂ ਦੇ ਨਾਲ ਬਹੁਤ ਜ਼ਿਆਦਾ ਲਗਾਵ ਹੈ ਮੈਨੂੰ ਆਪਣੇ ਘਰ ਦੇ ਵਿੱਚ ਪੌਦੇ ਲਗਾਉਣੇ ਬਹੁਤ ਚੰਗੇ ਲੱਗਦੇ ਨੇ ਇਹਨਾਂ ਦੇ ਜੇ ਦੇਖਿਆ ਜਾਵੇ ਤਾਂ ਆਪਾਂ ਬਹੁਤ ਸਾਰੇ ਬੈਨੀਫਿਟ ਸਾਡੇ ਸਾਹਮਣੇ ਆਉਂਦੇ ਨੇ ਇੰਝ ਕਹਿ ਲਵਾਂ ਕਿ ਪੌਦਿਆਂ ਦਾ ਮੇਰੇ ਜੀਵਨ ਦੇ ਨਾਲ ਬਹੁਤਾ ਲਗਾਵ ਹੈ ਅਤੇ ਇਹਨਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਇਫੈਕਟ ਵੀ ਪੈਂਦਾ ਅਤੇ ਨਾਲ ਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਰੋਜ਼ਾਨਾ ਇਹਨਾਂ ਵਿੱਚ ਪਾਣੀ ਪਾਉਣਾ ਬਹੁਤ ਹੀ ਮਤਲਬ ਚੰਗਾ ਲੱਗਦਾ ਦਿਲ ਨੂੰ ਇੱਕ ਤਰ੍ਹਾਂ ਦਾ ਸਕੂਨ ਜਿਹਾ ਮਿਲਦਾ ਇਹਨਾਂ ਇਹ ਵੀ ਮੰਨ ਲਓ ਇੱਕ ਤਰ੍ਹਾਂ ਦਾ ਸਾਡੇ ਘਰ ਦਾ ਇੱਕ ਤਰ੍ਹਾਂ ਆਪਾਂ ਕਹਿ ਦਈਏ ਵੀ ਸਦੱਸਿਆ ਜਾਨੀ ਜੀ ਇੱਕ ਤਰ੍ਹਾਂ ਦਾ ਮੈਂਬਰ ਦਾ ਰੋਲ ਅਦਾ ਕਰਦੇ ਨੇ ਅਤੇ ਰੋਜ਼ਾਨਾ ਹੀ ਮੈਂ ਜਦੋਂ ਸੁਬਾਹ ਉੱਠਦਾ ਗਾ ਤਾਂ ਇਹਨਾਂ ਵੱਲ ਦੇਖ ਕੇ ਇੱਕ ਚਿਹਰੇ 'ਤੇ ਛੋਟੀ ਜਿਹੀ ਆਪਾਂ ਕਹਿ ਦਈਏ ਮੁਸਕਾਨ ਜੀ ਜਿਹੜੀ ਆ ਜਾਂਦੀ ਹੈ ਚਿਹਰੇ ਉੱਪਰ ਜੇ ਆਪਾਂ ਗੱਲ ਕਰੀਏ ਜੇ ਪੌਦਿਆਂ ਦੀ ਦੇਖ ਸੰਭਾਲ ਦੀ ਦੇਖਭਾਲ ਦੀ ਇਹਨਾਂ ਦੀ ਸੰਭਾਲ ਦੀ ਇਹਨਾਂ ਦੀ ਕੇਅਰ ਦੀ ਗੱਲ ਕਰਦੇ ਹਾਂ ਆਪਾਂ ਤਾਂ ਮੈਂ ਰੋਜ਼ਾਨਾ ਆਪਣੇ ਪੌਦਿਆਂ ਨੂੰ ਦੇਖਦਾ ਹਾਂ ਇਹਨਾਂ ਵਿੱਚ ਟਾਈਮ ਟੂ ਟਾਈਮ ਪਾਣੀ ਪਾਉਂਦਾ ਹਾਂ ਅਗਰ ਮੈਨੂੰ ਕਈ ਵਾਰ ਇੱਦਾਂ ਲੱਗਦਾ ਹੈਗਾ ਵੀ ਇਹਨਾਂ ਪੌਦਿਆਂ ਵਿੱਚੋਂ ਕੋਈ ਥੋੜ੍ਹੀ ਮੋਟੀ ਇੱਦਾਂ ਦੀ ਕੋਈ ਕਮੀ ਲੱਗਦੀ ਹੈ ਜਾਂ ਪੌਦੇ ਦੀ ਗਰੋਥ ਨਹੀਂ ਹੋ ਰਹੀ ਪੌਦਾ ਸੁੱਕ ਰਿਹਾ ਗਾ ਤਾਂ ਸਾਡੇ ਪਿੰਡ ਵਿੱਚ ਜੋ ਹੈਗਾ ਇੱਕ ਮਾਲੀ ਹੈ ਉਹ ਮੰਨ ਲਓ ਡੇਲੀ ਰੂਟੀਨ ਦੇ ਵਿੱਚ ਹੀ ਸਾਡੇ ਪਿੰਡ ਵਿੱਚ ਚੱਕਰ ਲਗਾਉਂਦਾ ਗਾ ਕਿਉਂਕਿ ਪਿੰਡ ਵਿੱਚ ਹੋਰ ਹੀ ਬਹੁਤ ਸਾਰੇ ਘਰ ਇੱਦਾਂ ਦੇ ਨੇ ਜੋ ਕਿ ਆਪਾਂ ਕਹਿ ਦਈਏ ਕੁਦਰਤ ਨਾਲ ਪਿਆਰ ਕਰਦੇ ਨੇ ਬੂਟੇ ਲਗਾਉਣੇ ਬਹੁਤ ਹੀ ਚੰਗੀ ਗੱਲ ਸਮਝਦੇ ਨੇ ਆਪਣੇ ਘਰਾਂ ਵਿੱਚ ਤਾਂ ਸਾਡੇ ਪਿੰਡ ਉਹ ਮਾਲੀ ਆਉਂਦਾ ਹੈ ਤਾਂ ਮੈਂ ਮਾਲੀ ਨੂੰ ਆਪਣੇ ਘਰ ਬੁਲਾ ਕੇ ਇਹਨਾਂ ਬੂਟਿਆਂ ਵਾਸਤੇ ਜੋ ਵੀ ਹੋ ਸਕੇ ਜਿੰਨਾ ਕੁ ਹੋ ਸਕੇ ਇਹਨਾਂ ਨੂੰ ਪ੍ਰੋਪਰ ਉਹਨਾਂ ਦੀ ਗਰੋਥ ਵਾਸਤੇ ਜੋ ਵੀ ਮੰਨ ਲਓ ਇਹਨਾਂ ਦੇ ਵਿੱਚ ਪੌਦਿਆਂ ਵਿੱਚ ਜੜਾਂ ਵਿੱਚ ਘਾਟ ਹੈ ਉਹਨੂੰ ਪੂਰਾ ਕਰਨ ਵਾਸਤੇ ਇੱਕ ਵਾਰ ਮੈਂ ਮਾਲੀ ਨੂੰ ਜ਼ਰੂਰ ਬੁਲਾਉਣਾ ਗਾ ਤਾਂ ਕਿ ਇਹਨੂੰ ਪੌਦਿਆਂ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਵਾਸਤੇ ਸੁੰਦਰ ਅਤੇ ਇਹਨਾਂ ਦੀ ਗਰੋਥ ਅੱਪ ਕਰਨੇ ਵਾਸਤੇ ਮੈਂ ਜਿਹੜੀ ਹੈਗੀ ਹੈ ਪੂਰੀ ਤਰ੍ਹਾਂ ਦੀ ਕੋਸ਼ਿਸ਼ ਕਰਦਾਂ ਗਾ ਇਸ ਤੋਂ ਇਲਾਵਾ ਮਾਲੀ ਵੀ ਮੰਨ ਲਓ ਆ ਜਾਂਦਾ ਗਾ ਮਾਲੀ ਚੈੱਕ ਕਰ ਜਾਂਦਾ ਗਾ ਮਾਲੀ ਜੋ ਹੈਗੀ ਇਹਦੇ ਵਿੱਚ ਘਾਟ ਹੁੰਦੀ ਹੈ ਮਾਲੀ ਸਾਨੂੰ ਦੱਸਦਾ ਕਿ ਵੀ ਇੱਦਾਂ ਕਰਕੇ ਇਹਦੇ ਵਿੱਚ ਇੰਨਾਂ ਤੁਸੀਂ ਪਾਣੀ ਪਾਉਣਾ ਇਸ ਟਾਈਮ ਪਾਣੀ ਪਾਉਣਾ ਜਾਂ ਧੁੱਪ ਵਿੱਚ ਇਹਨੂੰ ਤੁਸੀਂ ਥੋੜ੍ਹਾ ਜਿਹਾ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਇਹਨੂੰ ਤੁਸੀਂ ਸਾਂਝ ਰੱਖਣਾ ਜਾਂ ਇੱਦਾਂ ਜੋ ਵੀ ਉਹ ਮੰਨ ਲਓ ਕੇਅਰਫੁੱਲ ਗੱਲਾਂ ਨੇ ਸਾਨੂੰ ਉਹ ਦੱਸਦਾ ਗਾ ਅਸੀਂ ਉਹ ਗੱਲਾਂ ਸਾਰੀਆਂ ਹੁੰਦੀਆਂ ਉਹ ਸੁਣਦੇ ਹਾਂ ਧਿਆਨ ਨਾਲ ਅਤੇ ਉਹਨਾਂ ਵਿੱਚ 'ਤੇ ਉੱਤੇ ਅਸੀਂ ਅਮਲ ਵੀ ਕਰਦੇ ਹਾਂ ਇਸ ਤੋਂ ਇਲਾਵਾ ਮੈਂ ਜੋ ਸਾਡੇ ਪਿੰਡ ਦੇ ਨਜ਼ਦੀਕ ਹੀ ਨਰਸਰੀ ਹੈ ਮੈਂ ਉੱਥੇ ਵੀ ਚਲਾ ਜਾਂਦਾ ਉੱਥੇ ਅਕਸਰ ਹੀ ਜਾ ਕੇ ਮੈਨੂੰ ਸਕੂਨ ਮਿਲਦਾ ਕਿਉਂਕਿ ਉੱਥੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਨੇ ਪੇੜ ਪੌਦੇ ਛੋਟੇ ਬੂਟੇ ਜੋ ਉੱਥੇ ਹੈਗੇ ਨੇ ਉਹ ਰੱਖੇ ਹੁੰਦੇ ਨੇ ਤਾਂ ਉੱਥੇ ਜਾ ਕੇ ਵੀ ਮੈਂ ਅਕਸਰ ਹੀ ਜੋ ਉੱਥੇ ਭਾਈ ਲੱਗੇ ਹੋਏ ਨੇ ਜਿਹਨਾਂ ਦੀ ਨਰਸਰੀ ਹੈ ਉੱਥੇ ਜਾ ਕੇ ਮੈਨੂੰ ਸਕੂਨ ਜਿਹਾ ਮਿਲਦਾ ਉੱਥੇ ਜਾ ਕੇ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਤਾਂ ਉਹਨਾਂ ਤੋਂ ਮੈਂ ਪੁੱਛਦਾ ਗਾ ਵੀ ਪੌਦਿਆਂ ਦੀ ਕਿਸ ਪ੍ਰਕਾਰ ਤੁਸੀਂ ਜਿਹੜੀ ਹੈਗੀ ਆ ਦੇਖਭਾਲ ਕਰਦੇ ਹੋ ਇ ਇੱਕ ਛੋਟੇ ਬੂਟੇ ਤੋਂ ਲੈ ਕੇ ਇੱਕ ਵੱਡਾ ਸਾਰਾ ਦਰਖਤ ਤੁਸੀਂ ਕਿੱਦਾਂ ਇਹ ਇਹਨਾਂ ਇਹ ਜਿਹੜੀ ਹੈਗੀ ਆ ਉਹ ਤੁਸੀਂ ਅਚੀਵਮੈਂਟ ਪ੍ਰਾਪਤ ਕਰ ਲੈਂਦੇ ਹੋ ਤਾਂ ਉਹਨਾਂ ਤੋਂ ਮੈਂ ਇਕੱਲੀ ਇਕੱਲੀ ਗੱਲ ਇੱਦਾਂ ਪੁੱਛਦਾ ਹਾਂ ਉਹਦੇ ਨਾਲ ਵੀ ਮੈਨੂੰ ਮੇਰੇ ਜਿਹੜੇ ਬੂਟੇ ਨੇ ਘਰ ਉਹਨਾਂ ਨੂੰ ਬਿਹਤਰ ਬਣਾਉਣ ਦੇ ਵਿੱਚ ਬਹੁਤ ਸਾਰੀ ਹੈਗੀ ਆ ਜਿਹੜੀ ਮੈਨੂੰ ਮੈਨੂੰ ਇੱਕ ਤਰ੍ਹਾਂ ਦੀ ਕਹਿ ਦੀ ਗੱਲ ਪਤਾ ਲੱਗਦੀ ਹੈ ਵੀ ਕਿੱਦਾਂ ਮੈਂ ਹੋਰ ਚੰਗੇ ਤਰੀਕੇ ਦੇ ਨਾਲ ਮੇਰੇ ਜੋ ਘਰ ਬੂਟੇ ਲਗਾਏ ਮੇਰੇ ਲਗਾਏ ਨੇ ਉਹਨਾਂ ਨੂੰ ਮੈਂ ਹੋਰ ਚੰਗੀ ਤਰ੍ਹਾਂ ਕਿਵੇਂ ਜਿਹੜੇ ਹੈਗੇ ਉਹਨਾਂ ਦੀ ਮੈਂ ਗਰੋਥ ਕਰ ਸਕਦਾ ਹਾਂ ਤਾਂ ਉਹ ਉੱਥੇ ਮੈਂ ਉਹਨਾਂ ਤੋਂ ਜਿਹੜੇ ਭਾਈ ਉੱਥੇ ਲੱਗੇ ਨੇ ਤਾਂ ਉਹਨਾਂ ਤੋਂ ਮੈਂ ਗੱਲਾਂ ਸੁਣਦਾ ਗਾ ਦੇਖਦਾ ਗਾ ਵੀ ਕਿੰਨਾ ਕੁ ਕਿੱਦਾਂ ਉਹ ਕਿਸ ਪ੍ਰਕਾਰ ਜੋ ਹੈਗੇ ਨੇ ਉਹ ਬੂਟਿਆਂ ਨੂੰ ਪਾਲਦੇ ਨੇ ਵੱਡੇ ਕਰਦੇ ਨੇ ਤਾਂ ਮੈਂ ਉਹ ਪੂਰੀ ਚੀਜ਼ ਦੇ ਉੱਤੇ ਅਮਲ ਕਰਕੇ ਉੱਥੇ ਦੇਖਦਾ ਗਾ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਸੋ ਮੈਨੂੰ ਉੱਥੇ ਜਾ ਕੇ ਵੀ ਬਹੁਤ ਚੰਗਾ ਲੱਗਦਾ ਗਾ ਜਦੋਂ ਉੱਥੇ ਮੈਂ ਚੰਗਾ ਕਈ ਪ੍ਰਕਾਰ ਦੇ ਪੇੜ ਪੌਦੇ ਬੂਟੇ ਮੈਂ ਦੇਖਦਾ ਗਾ ਉੱਥੇ ਤਾਂ ਮੈਨੂੰ ਦਿਲ ਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਗਾ ਇਸ ਲਈ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਗਾ ਹੁਣ ਵੀ ਕਿਸ ਪ੍ਰਕਾਰ ਬੂਟੇ ਦੀ ਇੱਕ ਚੰਗੇ ਬੂਟੇ ਦੀ ਆਪਾਂ ਕਹਿ ਦਈਏ ਪੇੜ ਪੌਦੇ ਦੀ ਕਿਸ ਪ੍ਰਕਾਰ ਦੇਖਭਾਲ ਕਰਨੀ ਹੈ ਅਤੇ ਉਸਨੂੰ ਹੋਰ ਉਹਦੀ ਹੋਰ ਗਰੋਥ ਕਰਨ ਵਾਸਤੇ ਕਿਸ ਤਰ੍ਹਾਂ ਉਹਦੀ ਕੇਅਰ ਕਰਨੀ ਹੈ ਉਹ ਮੈਂ ਦਿਨੋਂ ਦਿਨ ਪ੍ਰਤੀ ਦਿਨ ਮੈਂ ਸਿੱਖ ਰਿਹਾ ਹਾਂ ਅਤੇ ਮੈਂ ਹੋਰ ਵੀ ਡੀਪਲੀ ਪੌਦਿਆਂ ਬਾਰੇ ਜਿਹੜੀ ਹੈਗੀ ਆ ਜਾਣਕਾਰੀ ਮੈਂ ਪ੍ਰਾਪਤ ਕਰਨ ਦਾ ਇਛੁੱਕ ਹਾਂ ਅਤੇ ਮੈਂ ਕਰਦਾ ਰਹਾਂਗਾ ਸੋ ਅੱਜ ਦਾ ਦੌਰ ਹੀ ਇਸ ਪ੍ਰਕਾਰ ਦਾ ਦੌਰ ਹੈ ਕਿ ਸਾਨੂੰ ਜਿਹੜੇ ਹੈਗੇ ਨੇ ਪੇੜ ਪੌਦੇ ਬਹੁਤ ਜ਼ਿਆਦਾ ਲਗਾਉਣੇ ਚਾਹੀਦੇ ਨੇ ਜਿਵੇਂ ਕਿ ਹੁਣੇ ਹਾਲ ਦੇ ਵਿੱਚ ਹੀ ਆਪਣੇ ਜਿਹੜੇ ਹੈਗੇ ਨੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਜੀ ਉਹਨਾਂ ਨੇ ਵੀ ਇਹ ਨਾਰਾ ਲਗਾਇਆ ਹੈਗਾ ਵੀ ਇੱਕ ਪੇੜ ਆਪਣੀ ਮਾਂ ਦੇ ਨਾਮ 'ਤੇ ਕਹਿਣ ਦਾ ਭਾਵ ਵੀ ਸਾਡੇ ਕਰੰਟ ਦੇ ਵਿੱਚ ਆਪਾਂ ਜੇ ਜੁੜੀਏ ਕਰੰਟ ਦੇ ਅਫ ਅਫੇਅਰ ਨਾਲ ਆਪਾਂ ਦੇਖੀਏ ਆਪਣੇ ਕਰੰਟ ਦੇ ਵਿੱਚ ਕੀ ਚੱਲ ਰਿਹਾ ਆਪਣੇ ਤਾਂ ਸਾਨੂੰ ਪਤਾ ਲੱਗਦਾ ਕਿ ਹਾਲ ਹੀ ਵਿੱਚ ਜੋ ਹੈ ਬਹੁਤ ਵੱਡਾ ਟਾਰਗੇਟ ਹੈਗਾ ਇਹਦਾ ਵੀ ਸਾਨੂੰ ਵੱਧ ਤੋਂ ਵੱਧ ਬੂਟੇ ਜਿਹੜੇ ਹੈਗੇ ਨੇ ਪੇੜ ਪੌਦੇ ਸਾਨੂੰ ਲਗਾਉਣੇ ਚਾਹੀਦੇ ਨੇ ਜੋ ਕਿ ਸਾਡੇ ਵਾਤਾਵਰਨ ਦੇ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ ਇੰਪੋਰਟੈਂਸ ਰੱਖਦੇ ਬਹੁਤ ਜ਼ਿਆਦਾ ਸਾਡੇ ਵਾਤਾਵਰਨ ਨੂੰ ਹਰਾ ਭਰਾ ਰੱਖਣ ਦੇ ਵਾਸਤੇ ਸਾਡੀ ਮੋਸਟਲੀ ਕਹਿੰਦੇ ਕਿ ਸਾਡੀ ਸਿਹਤ ਵਾਸਤੇ ਬਹੁਤ ਚੰਗੇ ਨੇ ਅਸੀਂ ਦੇਖ ਰਹੇ ਹਾਂ ਸਾਡਾ ਵਾਤਾਵਰਨ ਦਿਨੋਂ ਦਿਨ ਪ੍ਰਦੂਸ਼ਿਤ ਹੋ ਰਿਹਾ ਹੈਗਾ ਤਰ੍ਹਾਂ ਤਰ੍ਹਾਂ ਦੇ ਗੈਸਾਂ ਜੋ ਸਾਡੇ ਕਹਿ ਦਈਏ ਵਾਤਾਵਰਨ ਦੇ ਆਲੇ ਦੁਆਲੇ ਘੁੰਮ ਰਹੀਆਂ ਨੇ ਦਿਨੋਂ ਦਿਨ ਸਾਡਾ ਜਿਹੜਾ ਹੈਗਾ ਵਾਤਾਵਰਨ ਉਹ ਪ੍ਰਦੂਸ਼ਿਤ ਹੋ ਰਿਹਾ ਹੈਗਾ ਇਹਨੂੰ ਸਾਫ ਸੁਥਰਾ ਰੱਖਣ ਦੇ ਵਾਸਤੇ ਸਾਨੂੰ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਹਰ ਇੱਕ ਪਰਸਨ ਨੂੰ ਆਪਾਂ ਨੇ ਘਰ ਇੱਕ ਦੋ ਜਿਹੜੇ ਹੈਗੇ ਨੇ ਬੂਟੇ ਉਹ ਜ਼ਰੂਰ ਲਗਾਉਣੇ ਚਾਹੀਦੇ ਨੇ ਅਤੇ ਉਹਨਾਂ ਦੀ ਪ੍ਰੋਪਰ ਚੰਗੀ ਤਰ੍ਹਾਂ ਦੇਖਭਾਲ ਉਹਨਾਂ ਦੀ ਕਰਨੀ ਚਾਹੀਦੀ ਹੈ ਤਾਂ ਇੱਥੇ ਮੈਂ ਇਹੀ ਮੇਰਾ ਮੁੱਖ ਜਿਹੜਾ ਹੈਗਾ ਬੋਲਣ ਦਾ ਤਰੀਕਾ ਸੀਗਾ ਇਹੀ ਮੇਰੀ ਗੱਲ ਮੁੱਖ ਸੀ ਵੀ ਅਸੀਂ ਜਿਹੜੀ ਹੈਗੀ ਆ ਪੌਦੇ ਦੀ ਦੇਖਭਾਲ ਕਿਸ ਤਰ੍ਹਾਂ ਕਰ ਸਕਦੇ ਹਾਂ ਸੋ ਐਂਡ 'ਤੇ ਮੈਂ ਇਹੀ ਕਹਿਣਾ ਚਾਹੁੰਦਾ ਗਾ ਵੀ ਬੂਟੇ ਦੀ ਚੰਗੀ ਤਰ੍ਹਾਂ ਕੇਅਰ ਸਾਨੂੰ ਕਰਨੀ ਚਾਹੀਦੀ ਹੈ ਅਗਰ ਅਸੀਂ ਕੁਝ ਬੂਟੇ ਬਾਰੇ ਬਹੁਤਾ ਨਹੀਂ ਜਾਣਦੇ ਤਾਂ ਸਾਡੇ ਆਸੇ ਪਾਸੇ ਦੇ ਆਪਾਂ ਦੇਖੀਏ ਵੀ ਸਾਡੇ ਮਾਲੀ ਹੁੰਦਾ ਤਾਂ ਉਹਨੂੰ ਘਰ ਇੱਕ ਵਾਰ ਬੁਲਾਉਣਾ ਚਾਹੀਦਾ ਗਾ ਅਤੇ ਉਹਨੂੰ ਪੁੱਛਣਾ ਚਾਹੀਦਾ ਵੀ ਇਸ ਬੂਟੇ ਵਾਸਤੇ ਅਸੀਂ ਕੀ ਕੁਝ ਕਰ ਸਕਦੇ ਹਾਂ ਇਸ ਨੂੰ ਇਹਦੀ ਗਰੋਥ ਚੰਗੀ ਤਰ੍ਹਾਂ ਗਰੋਥ ਕਰਨ ਦੇ ਲਈ ਅਸੀਂ ਕੀ ਕੁਝ ਕਰਨੇ ਚਾਹੀਦੇ ਆ ਤਾਂ ਸਾਨੂੰ ਉਹ ਸਾਰੇ ਤਰੀਕੇ ਸਾਨੂੰ ਅਪਣਾਉਣੇ ਚਾਹੀਦੇ ਨੇ ਸੋ ਸਾਨੂੰ ਇੱਕੋ ਉਪਰਾਲਾ ਕਰਨਾ ਚਾਹੀਦਾ ਕਿ ਆਪਣੇ ਆਸ ਪਾਸ ਦੇ ਇਲਾਕੇ 'ਚ ਜ਼ਰੂਰ ਬਹੁਤੇ ਨਹੀਂ ਤਾਂ ਇੱਕ ਪੇੜ ਪੌਦਾ ਅਸੀਂ ਜ਼ਰੂਰ ਲਗਾਈਏ ਅਤੇ ਉਹਦੀ ਚੰਗੀ ਤਰ੍ਹਾਂ ਦੇਖਭਾਲ ਕਰੀਏ ਇਸ ਨਾਲ ਕੀ ਹੈ ਸਾਡਾ ਆਲਾ ਦੁਆਲਾ ਹੋਰ ਸੁੰਦਰ ਹੋ ਜਾਏਗਾ ਤਾਂ ਅਸੀਂ ਹੋਰ ਲੰਮਾ ਸਮਾਂ ਕਹਿ ਦਈਏ ਇੱਕ ਚੰਗੀ ਖੁਸ਼ਹਾਲ ਜ਼ਿੰਦਗੀ ਅਸੀਂ ਬਤੀਤ ਕਰ ਸਕਦੇ ਹਾਂ